ਪਿਛਲੇ ਕੁਝ ਸਾਲਾਂ ਦੌਰਾਨ ਭਾਰਤ ਵਿੱਚ ਨਵੀਆਂ ਨੌਕਰੀਆਂ ਅਤੇ ਰੁਜ਼ਗਾਰ ਸਾਹਮਣੇ ਆਏ ਹਨ ਜਿਨ੍ਹਾਂ ਦੇ ਵਿੱਚ ਕਮੇਡੀਅਨ ਇੱਕ ਬਣਨਾ ਸੁਭਾਗ ਪ੍ਰਾਪਤ ਹੁੰਦਾ ਹੈ ਇਸਦੇ ਲਈ ਕਾਫੀ ਮਿਹਨਤ ਦੀ ਵੀ ਲੋੜ ਹੈ ਪੰਜਾਬ ਦੇ ਵਿੱਚ ਨਵੀਆਂ ਪੰਜਾਬੀ ਫਿਲਮਾਂ ਬਣ ਰਹੀਆਂ ਹਨ ਜਿਸ ਵਿੱਚ ਛੋਟੇ ਤੋਂ ਵੱਡੇ ਤੱਕ ਕਾਫੀ ਕਲਾਕਾਰਾਂ ਨੂੰ ਪ੍ਰੋਤਸਾਹਨ ਮਿਲ ਰਿਹਾ ਹੈ ਯੂਟਿਊਬ 'ਤੇ ਆਪਣੀ ਕੋਈ ਵੀ ਨਵੇਂ ਕੰਟੈਂਟ ਦਾ ਵੀਡੀਓ ਬਣਾ ਕੇ ਉਸ ਨੂੰ ਲਾਇਕ ਸ਼ੇਅਰ ਕਰਨ 'ਤੇ ਕਾਫੀ ਪੈਸੇ ਕਮਾਏ ਜਾ ਸਕਦੇ ਹਨ ਇਸ ਤੋਂ ਇਲਾਵਾ ਕਈ ਲੋਕ ਟਰੈਵਲਿੰਗ ਦੇ ਖੇਤਰ ਵਿੱਚ ਵੀ ਆਪਣਾ ਨਾਮ ਬਣਾ ਰਹੇ ਹਨ ਅਤੇ ਭਾਰਤ ਦੇ ਬਾਕੀ ਲੋਕਾਂ ਨੂੰ ਕਾਫੀ ਥਾਵਾਂ ਨਵੀਆਂ ਨਵੀਆਂ ਵਿਖਾ ਕੇ ਉਹਨਾਂ ਦੀ ਜਾਣਕਾਰੀ ਵਿੱਚ ਵਾਧਾ ਕਰ ਰਹੇ ਹਨ